ਪੈਸੇ ਬਚਾਉਣ ਵਾਸਤੇ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਕਿ ਆਪਾਂ ਨੂੰ ਵੇਖਣਾ ਪੈਣਾ ਕਿ ਆਪਾਂ ਕਿਸ ਤਰੀਕੇ ਦਾ ਪੈਸਾ ਬਚਾਉਣਾ ਚਾਹੁੰਦੇ ਹਾਂ ਕਿਸ ਲੈਵਲ ਤੱਕ ਪੈਸਾ ਬਚਾਉਣਾ ਚਾਹੁੰਦੇ ਹਾਂ ਇਹ ਨਾ ਹੋਵੇ ਕਿ ਪੈਸੇ ਬਚਾਉਣ ਕਰਕੇ ਅਸੀਂ ਆਪਣੇ ਡੇਲੀ ਲਾਈਫ ਨੂੰ ਸਪੋਇਲ ਕਰ ਦਈਏ ਅਤੇ ਪੈਸੇ ਬਚਾਉਣ ਦੇ ਬਹੁਤ ਤਰੀਕੇ ਨੇ ਜਿਵੇਂ ਆਪਾਂ ਦੇਖ ਸਕਦੇ ਹੈਗੇ ਆਪਾਂ ਕੋਈ ਐਫ ਡੀ ਵੀ ਕਰਵਾ ਸਕਦੇ ਹਾਂ ਦੇਖਦੇ ਹਾਂ ਆਪਾਂ ਕੋਈ ਗੋਲਡ ਖਰੀਦ ਲਿਆ ਜਾਂ ਆਪਣੇ ਕੋਈ ਜ਼ਮੀਨ ਖਰੀਦ ਲਿਆ ਜਿਨ੍ਹਾਂ ਨੂੰ ਆਪਾਂ ਖਰੀਦ ਲਿਆ ਅਤੇ ਉਹ ਪੈਸਾ ਬਚਿਆ ਹੀ ਹੈ ਉਹਨੇ ਸਾਨੂੰ ਪੈਸੇ ਨੇ ਪੈਸਾ ਹੀ ਦੇਣਾ ਅਤੇ ਇਹਦੇ ਇਲਾਵਾ ਮਿਊਚਲ ਫੰਡ ਦੇ ਵਿੱਚ ਵੀ ਆਪਾਂ ਪੈਸਾ ਲਾ ਸਕਦੇ ਹਾਂ ਸ਼ੇਅਰ ਮਾਰਕੀਟ ਦੇ ਵਿੱਚ ਲਾ ਸਕਦੇ ਹਾਂ ਪਰ ਉੱਥੇ ਚੱਕਰ ਇਹ ਹੈ ਵੀ ਕਿ ਪੈਸਾ ਆ ਜੇ ਤਾਂ ਬਹੁਤ ਵਧੀਆ ਆ ਜੇ ਜੇ ਨਾ ਆਵੇ ਜਿਹੜਾ ਲੱਗਾ ਉਹ ਵੀ ਜਾਵੇ ਅਤੇ ਇਸ ਕਰਕੇ ਜਿਹੜੇ ਸਾਡੇ ਬਹੁਤ ਹੀ ਤਾਂ ਲੋਕ ਯਕੀਨਨ ਹੈਗੇ ਆ ਜਿੱਥੇ ਸਾਨੂੰ ਪਤਾ ਹੀ ਪਤਾ ਕਿ ਪੈਸਾ ਆਉਣਾ ਹੀ ਆਉਣਾ ਉਹਦੇ ਵਿੱਚ ਇੱਕ ਤਾਂ ਐਫ ਡੀ ਹੋ ਗਿਆ ਇੱਕ ਸਾਡਾ ਸੋਨਾ ਖਰੀਦਣ ਦਾ ਹੋ ਗਿਆ ਜ਼ਮੀਨ ਜਾਇਦਾਦ ਖਰੀਦਣ ਦਾ ਹੋ ਗਿਆ ਅਤੇ ਇਹ ਚੀਜ਼ਾਂ ਸਾਨੂੰ ਪੈਸਾ ਦਿੰਦੀਆਂ ਹੀ ਦਿੰਦੀਆਂ ਵਾ